ਮੈਂ ਆਪਣੀ ਸਾਈਕਲ ਦੀ ਜਾਂਚ ਸਮੇਂ ਸਮੇਂ 'ਤੇ ਕਰਵਾਉਂਦਾ ਰਹਿੰਦਾ ਸੀ ਕਿ ਵੀਹ ਦਿਨਾਂ ਬਾਅਦ ਮੈਂ ਆਪਣੇ ਸਾਈਕਲਾਂ ਦੀ ਰਬੜਾਂ ਬਰੇਕਾਂ ਅਤੇ ਸਾਈਕਲ ਨੂੰ ਤੇਲ ਪਵਾਉਂਦਾ ਰਹਿੰਦਾ ਸੀਗਾ ਜਿਸ ਕਰਕੇ ਮੇਰੀ ਸਾਈਕਲ ਸਹੀ ਤਰੀਕੇ ਨਾਲ ਚੱਲਦੀ ਰਹਿੰਦੀ ਸੀਗੀ ਜੇ ਸਾਈਕਲ ਜਦੋਂ ਮੈਂ ਚਲਾਉਂਦਾ ਸੀ ਤਾਂ ਕਾਫੀ ਥਕਾਵਟ ਵੀ ਹੁੰਦੀ ਸੀ ਕਿਉਂਕਿ ਮੇਰੇ ਮੈਂ ਆਪਣੇ ਘਰ ਤੋਂ ਸਕੂਲ ਜਾਂਦਾ ਹੁੰਦਾ ਸੀ ਜੋ ਬਹੁਤ ਲੰਬਾ ਰਸਤਾ ਸੀ ਜਿਸ ਕਰਕੇ ਗਰਮੀਆਂ ਵਿੱਚ ਬਹੁਤ ਥਕਾਵਟ ਹੋ ਜਾਂਦੀ ਸੀ ਪਸੀਨੋ ਪਸੀਨ ਹੋ ਜਾਂਦੇ ਸੀਗੇ ਅਤੇ ਕਾਫੀ ਲੰਬਾ ਰੂਟ ਹੋਣ ਕਰਕੇ ਮੈਨੂੰ ਸੁਚੇਤ ਹੋ ਕੇ ਵੀ ਆਪਣੀ ਸਾਈਕਲ ਚਲਾਉਣੀ ਪੈਂਦੀ ਸੀ ਮੈਂ ਹਮੇਸ਼ਾ ਆਪਣੀ ਸਾਈਕਲ ਸਾਈਕਲ ਵਾਲੀ ਲੇਨ ਵਿੱਚ ਹੀ ਚਲਾਉਂਦਾ ਸੀਗਾ ਜਿਸ ਕਾਰਨ ਮੈਂ ਦੂਜੀਆਂ ਗੱਡੀਆਂ ਅਤੇ ਵਾਹਨਾਂ ਵਿਤੋਂ ਬਚਿਆ ਰਹਿੰਦਾ ਸੀਗਾ ਕਿਉਂਕਿ ਅੱਜ ਕੱਲ੍ਹ ਮੈਂ ਬਹੁਤ ਦੇਖਦਾ ਹਾਂ ਕਿ ਲੋਕ ਸਾਇਕਲਾਂ ਵਾਲਿਆਂ ਨੂੰ ਠੋਕ ਕੇ ਭੱਜ ਜਾਂਦੇ ਹਨ ਜਿਸ ਕਰਕੇ ਉਹਨਾਂ ਦੀ ਜਾਨ 'ਤੇ ਬਣ ਜਾਂਦੀ ਹੈ ਅਤੇ ਇਸ ਲੰਬੇ ਰੂਟ 'ਤੇ ਮੈਂ ਪ੍ਰੇਰਿਤ ਇਸ ਤਰ੍ਹਾਂ ਰਹਿੰਦਾ ਸੀਗਾ ਕਿ ਜੇ ਮੈਂ ਅ ਟਾਈਮ ਸਿਰ ਪਹੁੰਚ ਜਾਵਾਂ ਅਤੇ ਮੇਰੀ ਸਿਹਤ ਦਾ ਵੀ ਖਿਆਲ ਨਾਲ ਬਣਿਆ ਰਹੇ ਜਿਸ ਕਰਕੇ ਮੈਂ ਬਹੁਤ ਪ੍ਰੇਰਿਤ ਰਹਿੰਦਾ ਸੀਗਾ ਕਿ ਮੇਰੀ ਸਿਹਤ ਵੀ ਨਾਲ ਨਾਲ ਬਣਦੀ ਹੈ ਅਤੇ ਮੈਂ ਆਪਣਾ ਕੰਮ ਵੀ ਕਰ ਰਿਹਾ ਅਤੇ ਇਸ ਤਰ੍ਹਾਂ ਮੈਂ ਆਪਣੀ ਸਾਈਕਲ ਦਾ ਧਿਆਨ ਵੀ ਰੱਖਦਾ ਸੀ ਅਤੇ ਮੈਂ ਉਸ ਨੂੰ ਚਲਾਉਣ ਲਈ ਪ੍ਰੇਰਿਤ ਵੀ ਰਹਿੰਦਾ ਸੀਗਾ